ਬਾਈ ਅਗਸਤ ਉੱਨੀ ਸੌ ਨੜਿਨਵੇਂ ਗਿਆਰਾਂ ਨਵੰਬਰ ਉੱਨੀ ਸੌ ਪੈਂਹਠ ਇਕੱਤੀ ਅਕਤੂਬਰ ਦੋ ਹਜ਼ਾਰ ਬਾਰ੍ਹਾਂ ਇੱਕ ਜਨਵਰੀ ਦੋ ਹਜ਼ਾਰ ਵੀਹ ਪੰਦਰਾਂ ਸਤੰਬਰ ਦੋ ਹਜ਼ਾਰ ਤੇਰ੍ਹਾਂ